ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਸਵੀਗੀ ਤੋਂ ਬੋਲ ਰਹੇ ਹੋ ਜੀ ਸਰ ਮੇਰਾ ਨਾਮ ਬਬੀਤਾ ਹੈ ਜੀ ਮੈਂ ਕਬੀਰ ਪਾਰਕ ਤੋਂ ਬੋਲ ਰਹੀ ਹਾਂ ਸਰ ਮੈਂ ਥੋੜ੍ਹੀ ਦੇਰ ਪਹਿਲਾਂ ਯੂਨੀਵਰੈਸਟੋ 'ਤੇ ਇੱਕ ਔਡਰ ਪਾਇਆ ਸੀ ਜੀ ਪੀਜ਼ਾਜ ਦਾ ਅਤੇ ਅਜੇ ਤੱਕ ਉਹ ਮੇਰਾ ਔਡਰ ਡਿਲੀਵਰ ਨਹੀਂ ਹੋਇਆ ਮੈਂ ਉਹਨਾਂ ਨੂੰ ਰੈਸਟੋਰੈਂਟ 'ਚ ਕੋਲ ਕੀਤੀ ਹੈ ਬਟ ਉਹ ਕਹਿ ਰਹੇ ਆ ਕਿ ਥੋੜੀ ਪੇਮੈਂਟ ਨਹੀਂ ਅਜੇ ਤੱਕ ਆਈ ਅਤੇ ਸਰ ਮੈਂ ਗੂਗਲ ਪੇ ਤੋਂ ਪੇਮੈਂਟ ਕੀਤੀ ਹੋਈ ਹੈ ਜੀ ਉਹਨਾਂ ਨੂੰ ਮੇਰੇ ਅਕਾਊਂਟ ਤਾਂ ਵਿੱਚੋਂ ਇਹ ਪੇਮੈਂਟ ਕੱਟ ਹੋ ਚੁੱਕੀ ਹੈ ਪਰ ਉਹਨਾਂ ਤੱਕ ਅਜੇ ਤੱਕ ਡਿਲੀਵਰ ਨਹੀਂ ਹੋਈ ਜਿਸ ਕਾਰਨ ਮੇਰਾ ਔਡਰ ਬਹੁਤ ਲੇਟ ਹੋ ਗਿਆ ਅਤੇ ਸਰ ਮੇਰੇ ਘਰ ਫੰਕਸ਼ਨ ਹੈ ਅਤੇ ਮੈਂ ਕਾਫੀ ਵੱਡਾ ਔਡਰ ਉਹਨਾਂ ਨੂੰ ਪਾਇਆ ਹੋਇਆ ਅਤੇ ਮੈਨੂੰ ਬੜੀ ਪ੍ਰੋਬਲਮ ਆ ਰਹੀ ਹੈ ਸੋ ਤੁਸੀਂ ਪਲੀਜ਼ ਕਿਸੇ ਤਰ੍ਹਾਂ ਮੈਨੂੰ ਕੋਈ ਦੱਸ ਸਕਦੇ ਹੋ ਕਿ ਮੈਂ ਕਿਵੇਂ ਕਿਹਨੂੰ ਕੰਪਲੇਂਟ ਕਰਾਂ ਜਾਂ ਕਿਵੇਂ ਆਪਣੀ ਪੇਮੈਂਟ ਦਾ ਦੁਬਾਰਾ ਕਰਵਾ ਸਕਦੀ ਹਾਂ ਜਾਂ ਰਿਲੀਜ਼ ਕਰਾ ਸਕਦੀ ਹਾਂ ਸਰ ਮੇਰੀ ਪਲੀਜ਼ ਹੈਲਪ ਕਰੋ ਜੀ ਥੈਂਕ ਯੂ ਜੀ